ਪੰਜਾਬੀ ਭਾਸ਼ਾ ਦੀ ਵਰਤੋਂ ਸਥਾਨਿਕ ਆਰਥਿਕਤਾ ਵਿੱਚ ਕੀਤੀ ਜਾਂਦੀ ਹੈ ਜਿਵੇਂ ਕਿ ਵਪਾਰ ਅਤੇ ਵਚਨ ਪੰਜਾਬੀ ਭਾਸ਼ਾ ਇੱਕ ਭਾਸ਼ਾ ਹੈ ਜਿਸ ਵਿੱਚ ਅਸੀਂ ਆਪਣੇ ਵਿਚਾਰਾਂ ਨੂੰ ਦੂਜੇ ਦੇ ਸਾਹਮਣੇ ਪ੍ਰਗਟ ਕਰਦੇ ਹਨ ਅਕਸਰ ਵਪਾਰ ਵਿੱਚ ਬਹੁਤ ਹੀ ਵਪਾਰੀ ਜੋ ਹੁੰਦੇ ਹਨ ਬਹੁਤ ਹੀ ਘੱਟ ਸੁਣਦੇ ਹਨ ਪਰ ਪੰਜਾਬੀ ਭਾਸ਼ਾ ਦੇ ਕਰਕੇ ਅਸੀਂ ਇਹਨਾਂ ਨੂੰ ਆਪਣੀ ਗੱਲ ਸੁਣਾ ਸਕਦੇ ਹਨ ਅਤੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਸਮਝਾ ਸਕਦੇ ਹਨ ਕਿ ਸਾਡੇ ਕੋਲ ਇਹ ਹੈ ਸਾਨੂੰ ਇਹ ਚਾਹੀਦਾ ਹੈ ਅਤੇ ਅਗਰ ਅਸੀਂ ਵਪਾਰ ਨੂੰ ਛੱਡ ਕੇ ਅਸੀਂ ਅਗਰ ਮੰਨ ਲਓ ਕਿਸੇ ਰੈਸਟੋਰੈਂਟ ਜਾਂਦੇ ਹਨ ਅਸੀਂ ਉੱਥੇ ਜਾ ਕੇ ਕੁਛ ਔਰਡਰ ਕਰਦੇ ਹਨ ਸਾਨੂੰ ਉੱਥੇ ਪਿਆਰ ਨਾਲ ਬੋਲਣਾ ਚਾਹੀਦਾ ਹੈਗਾ ਅਤੇ ਉਹਦੇ ਵਿੱਚ ਵੀ ਭਾਸ਼ਾ ਹੀ ਕੰਮ ਆਉਂਦੀ ਹੈ ਜਿਵੇਂ ਕਿ ਪੰਜਾਬੀ ਭਾਸ਼ਾ ਪੰਜਾਬੀ ਭਾਸ਼ਾ ਵਿੱਚ ਅਸੀਂ ਉਹਨਾਂ ਨੂੰ ਪਿਆਰ ਨਾਲ ਬੋਲ ਸਕਦੇ ਹਨ ਉਹ ਸਾਡੀ ਗੱਲ ਸਮਝ ਸਕਦੇ ਉਹ ਸਾਨੂੰ ਅੱਗੇ ਰਿਪਲਾਈ ਕਰ ਸਕਦੇ ਹਨ ਅਤੇ ਰਹੀ ਗੱਲ ਵਪਾਰ ਦੀ ਵਪਾਰ ਵਿੱਚ ਪੰਜਾਬ ਵਿੱਚ ਜਿਵੇਂ ਕਿ ਬਹੁਤ ਹੀ ਉਹ ਲੋਕ ਹੁੰਦੇ ਹਨ ਖੇਤੀ ਕਰਨ ਵਾਲੇ ਲੋਕ ਹੁੰਦੇ ਹਨ ਜਿਹੜੀ ਖੇਤੀ ਕਰਨ ਨੂੰ ਕਿਸਾਨ ਹੁੰਦੇ ਆ ਉਹ ਹਮੇਸ਼ਾ ਹੀ ਬਹੁਤ ਹੀ ਖੜੀ ਪੰਜਾਬੀ ਬੋਲਦੇ ਹਨ ਉਹਨਾਂ ਦੇ ਜਿਹੜੀ ਗਲਾ ਹੁੰਦਾ ਆ ਉਹ ਬਹੁਤ ਹੀ ਉੱਚੀ ਪੰਜਾਬੀ ਬੋਲਦਾ ਹੈ ਜਿਸ ਜੋ ਇਹਨਾਂ ਨੂੰ ਵਪਾਰ ਵਿੱਚ ਮਦਦ ਕਰਦਾ ਹੈ ਜਿਵੇਂ ਕਿ ਅਗਰ ਮੰਨ ਲਓ ਸਬਜ਼ੀ ਮੰਡੀ ਜਾਂਦੇ ਹਨ ਸਬਜ਼ੀ ਮੰਡੀ 'ਚ ਬਹੁਤ ਹੀ ਰੌਲਾ ਹੁੰਦਾ ਹੈ ਬਹੁਤ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਹਨ ਗੱਡੀ ਦੀ ਸਕੂਟਰ ਦੀ ਮੋਟਰਸਾਈਕਲ ਦੀ ਪਰ ਪੰਜਾਬੀ ਇਕੱਲੀ ਇੱਦਾਂ ਦੀ ਬੋਲੀ ਹੈ ਜੋ ਬਹੁਤ ਹੀ ਉੱਚੀ ਬੋਲੀ ਜਾ ਸਕਦੀ ਹੈ ਕਿਉਂਕਿ ਮੰਡੀ ਵਿੱਚ ਸਾਨੂੰ ਬਹੁਤ ਹੀ ਉੱਚੀ ਬੋਲਣਾ ਪੈਂਦਾ ਹੈ ਅਤੇ ਪੰਜਾਬੀ ਬੋਲੀ ਉਹਦੇ ਲਈ ਸਭ ਤੋਂ ਵਧੀਆ ਹੈ ਅਸੀਂ ਬਹੁਤ ਉੱਚੀ ਉੱਚੀ ਬੋਲ ਕੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦੇ ਹਨ ਆਪਾਂ ਉਹਨਾਂ ਨੂੰ ਆਪਣੇ ਪ੍ਰੋਡਕਟ ਦਿਖਾ ਸਕਦੇ ਹਨ ਉਹਨਾਂ ਨੂੰ ਆਪਣੀਆਂ ਵੇਚ ਕੇ ਆਪਣੇ ਪ੍ਰੋਡਕਟ ਵੇਚ ਕੇ ਆਪਣਾ ਪ੍ਰੋਫਿਟ ਕਰ ਸਕਦੇ ਹਨ ਆਪਣਾ ਮੁਨਾਫ਼ਾ ਕਰ ਸਕਦੇ ਹਨ ਧੰਨਵਾਦ